ਹਾਂ ਮੈਂ ਸਕਰੈਚ ਤੋਂ ਕਾ ਬਚਪਨ ਤੋਂ ਹੀ ਕੁਛ ਨਾ ਕੁਛ ਬਣਾਉਣ ਦੀ ਮੈਨੂੰ ਆਦਤ ਸੀ ਕੋਸ਼ਿਸ਼ ਕਰਦੀ ਸੀ ਮੈਂ ਆਪਣੀ ਮਾਤਾ ਜੀ ਨਾਲ ਬਚਪਨ ਤੋਂ ਬਚਪਨ ਵਿੱਚ ਮੇਰੇ ਮਾਤਾ ਜੀ ਸਾਨੂੰ ਸ਼ਨੀਲ ਦੀਆਂ ਲੀਰਾਂ ਲਿਆ ਕੇ ਦਿੰਦੇ ਸੀ ਅਸੀਂ ਉਹਨਾਂ ਨੂੰ ਕੱਟ ਕੇ ਘਰ ਵਿੱਚ ਦਰੀ ਬੁਣ ਕੇ ਦਰੀਆਂ ਬਣਾਉਂਦੇ ਸੀ ਮੈਂ ਵੈਸੇ ਆਪਣੇ ਮਾਤਾ ਜੀ ਨਾਲ ਅਤੇ ਉਹ ਚਰਖਾ ਕੱਤਦੇ ਸਨ ਤਾਂ ਚਰਖਾ ਕੱਤ ਕੇ ਉਹ ਫਿਰ ਉਹਦੇ ਧਾਗੇ ਬਣਾ ਕੇ ਰੰਗ ਕਰਕੇ ਅਸੀਂ ਉਹ ਦਰੀਆਂ ਬੁਣਦੇ ਸੀ ਘਰ ਵਿੱਚ ਅਤੇ ਉਹ ਸਾਨੂੰ ਬਚਪਨ 'ਚ ਜਿਵੇਂ ਨਹੀਂ ਆਉਂਦੀਆਂ ਸੀ ਬੁਣਨੀਆਂ ਤਾਂ ਸਾਨੂੰ ਉਹ ਕੀ ਕਰਦੇ ਸੀਗੇ ਕਿ ਪੁਰਾਣੀਆਂ ਲੀਰਾਂ ਦੇ ਦਿੰਦੇ ਸੀ ਅਸੀਂ ਉਹਨਾਂ ਲੀਰਾਂ ਤੋਂ ਮੈਟ ਬਣਾ ਲੈਣੇ ਛੋਟੀਆਂ ਛੋਟੀਆਂ ਦਰੀਆਂ ਬਣਾਉਣੀਆਂ ਜਿਹੜੀਆਂ ਅਸੀਂ ਘਰਾਂ 'ਚ ਰੱਖਦੇ ਸੀ ਇਸ ਤਰ੍ਹਾਂ ਮੈਂ ਸਕਰੈਚ ਤੋਂ ਕੁਛ ਨਾ ਕੁਛ ਦਰੀਆਂ ਬਣਾਉਂਦੀ ਰਹਿੰਦੀ ਸੀ ਬਚਪਨ 'ਚ ਪਰ ਅੱਜ ਕੱਲ੍ਹ ਜਿਵੇਂ ਕਿ ਹੁਣ ਜ਼ਮਾਨਾ ਬਦਲ ਗਿਆ ਹੁਣ ਚਰਖੇ ਨਹੀਂ ਰਹੇ ਲੋਕ ਘਰ ਵਿੱਚ ਰੂੰ ਨਹੀਂ ਕੱਤਦੇ ਤਾਂ ਇਸ ਤਰ੍ਹਾਂ ਮੈਂ ਕੀ ਕਰਦੀ ਹਾਂ ਮੈਂ ਥੋ ਪੁਰਾਣੀਆਂ ਜਿਵੇਂ ਚੁੰਨੀਆਂ ਪਈਆਂ ਹੁੰਦੀਆਂ ਹਨ ਉਹਨਾਂ ਨੂੰ ਕੱਟ ਕੇ ਕਰੋਸ਼ੀਏ ਨਾਲ ਉਹਨਾਂ ਦੇ ਮੈਟ ਬਣਾ ਲੈਂਦੀ ਹਾਂ ਅਤੇ ਆਪਣੇ ਘਰ ਵਿੱਚ ਸਜਾਨੀ ਹਾਂ ਜਾਂ ਫਿਰ ਜਿਵੇਂ ਹੁਣ ਘਰ ਵਿੱਚ ਪ ਪੁਰਾਣੇ ਕੱਪ ਟੁੱਟ ਜਾਂਦੇ ਨੇ ਜਾਂ ਕੋਈ ਬਰਤਨ ਟੁੱਟ ਜਾਂਦਾ ਮੈਂ ਉਹਨੂੰ ਰੰਗ ਪੇਂਟ ਕਰਕੇ ਉਹਦੇ ਗਮਲੇ ਬਣਾ ਲੈਂਦੀ ਹਾਂ ਪਲਾਸਟਿਕ ਦੀਆਂ ਬੋਤਲਾਂ ਨੂੰ ਪੇਂਟ ਕਰਕੇ ਅੱਜ ਕੱਲ੍ਹ ਗਮਲੇ ਬਣਾ ਲੈਂਦੇ ਹਾਂ ਜਾਂ ਤਾਂ ਕਰੋਸ਼ੀਏ ਨਾਲ ਬੁਣ ਕੇ ਮੈਂ ਸੀਨਰੀ ਬਣਾ ਲੈਂਦੀ ਹਾਂ ਫਿਰ ਕਰੋਸ਼ੀਆਂ ਦੇ ਬਿਛੋਣੇ ਜਿਵੇਂ ਰੁਮਾਲ ਜਾਂ ਟੇਬਲ ਮੈਟ ਬਣਾ ਲੈਂਦੀ ਹਾਂ ਇਸ ਤਰ੍ਹਾਂ ਮੈਂ ਆਪਣੇ ਘਰ ਨੂੰ ਸਜਾਨੀ ਹਾਂ ਅਤੇ ਘਰ ਵਿੱਚ ਬਹੁਤ ਸਾਰੀਆਂ ਹੱਥ ਨਾਲ ਬਣੀਆਂ ਹੋਈਆਂ ਸੀਨਰੀਆਂ ਧਾਗਿਆਂ ਨਾਲ ਬਣਾ ਕੇ ਸੀਨਰੀਆਂ ਲਾਨੀ ਹਾਂ